ਸੱਸਰੀਕਾਲ ਜੀ ਨਾਮ ਮੇਰਾ ਗੁਰਿੰਦਰ ਕੌਰ ਮੈਂ ਤੁਹਾਡੇ ਢਾਬੇ 'ਤੇ ਆਪਣੀਆਂ ਦੋ ਥਾਲੀਆਂ ਔਡਰ ਕੀਤੀਆਂ ਸੀ ਖਾਣੇ ਦੀਆਂ ਜਿਸ ਵਿੱਚ ਜੋ ਮੈਂ ਕਿਹਾ ਤੁਹਾਡੇ ਤੋਂ ਮੈਂ ਦਾਲ਼ ਮਖਣੀ ਕਹੀ ਹੈ ਅਤੇ ਤੁਸੀਂ ਪਨੀਰ ਭੇਜਿਆ ਇਹਨੂੰ ਵਾਪਸ ਲੈ ਲਿਓ ਅਤੇ ਮੇਰਾ ਔਡਰ ਜੇ ਤੁਹਾਨੂੰ ਗਲਤ ਲੱਗਦਾ ਤਾਂ ਦੱਸੋ ਜੇ ਸਹੀ ਹੈ ਤਾਂ ਮੇਰੀ ਮੰਗਾਈ ਹੋਈ ਚੀਜ਼ ਹੀ ਮੈਨੂੰ ਵਾਪਸ ਔਡਰ ਕਰ ਦਿਓ ਅਤੇ ਜੇ ਨਹੀਂ ਹੈ ਤਾਂ ਪਲੀਜ਼ ਮੇਰੇ ਪੈਸੇ ਵਾਪਸ ਕਰ ਦਿਓ ਮੈਨੂੰ ਕੋਈ ਇਤਰਾਜ਼ਗੀਰੀ ਨਹੀਂ ਹੈਗੀ ਕੋਈ ਉਹ ਗਲਤ ਨਹੀਂ ਹੈਗਾ ਵੀ ਹਾਂ ਮੈਂ ਤੁਹਾਡੇ 'ਤੇ ਜ਼ਬਰਦਸਤੀ ਕਰ ਰਹੀ ਵੀ ਹਾਂ ਮੈਨੂੰ ਉਹੀ ਚਾਹੀਦਾ ਨਹੀਂ ਹੈ ਤਾਂ ਕੋਈ ਗੱਲ ਨਹੀਂ ਪੈਸੇ ਵਾਪਸ ਕਰ ਦਿਓ ਕੋਈ ਗੁੱਸਾ ਨਹੀਂ ਹੈਗਾ ਧੰਨਵਾਦ